ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਕ੍ਰੇਟਿਵ ਫੂਡਸ ਤੋਂ ਬੋਲਦੇ ਹੋ ਹਾਂਜੀ ਸਰ ਅਸੀਂ ਖਾਣ ਵਾਲੇ ਚੀਜ਼ਾਂ ਕੁਛ ਆਰਡਰ ਕੀਤੀਆਂ ਸੀ ਜਿਸ ਦੇ ਵਿੱਚ ਮਨਚੂਰੀਅਨ ਨਿਊਡਲ ਸੀ ਅਤੇ ਸਰ ਮਿਠਾਈ ਦੇ ਵਿੱਚ ਰਸ ਮਲਾਈ ਵੀ ਆਰਡਰ ਕੀਤੀ ਸੀ ਅਤੇ ਮੈਂ ਦਸ ਇਹ ਤੁਹਾਨੂੰ ਦੱਸਣਾ ਚਾਹੁੰਦੀ ਆ ਕੇ ਮਨਚੂਰੀਅਨ ਦੇ ਵਿੱਚ ਨਮਕ ਦੀ ਮਾਤਰਾ ਬਹੁਤ ਘੱਟ ਸੀ ਜਿਸ ਨੂੰ ਖਾਣ 'ਚ ਸੁਆਦ ਬਿਲਕੁਲ ਨਹੀਂ ਸੀ ਅਤੇ ਰਸ ਮਲਾਈ ਦੇ ਵਿੱਚ ਵੀ ਮਿੱਠਾ ਬਹੁਤ ਘੱਟ ਸੀ ਕਿਰਪਾ ਕਰਕੇ ਅੱਗੇ ਤੋਂ ਇਨ੍ਹਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਖਾਣ ਵਾਲੇ ਚੀਜ਼ਾਂ ਦਾ ਸੁਆਦ ਦਾ ਧਿਆਨ ਰੱਖੋ ਅਤੇ ਅੱਗੇ ਨੂੰ ਫਿਰ ਦੁਬਾਰਾ ਤੋਂ ਅਸੀਂ ਆਪਾਂ ਆਰਡਰ ਤੁਹਾਨੂੰ ਕਰ ਸਕੀਏ